ਮੇਰਾ ਨਾਮ ਰਾਕੇਸ਼ ਹੈ ਮੈਂ ਪਠਾਨਕੋਟ ਜ਼ਿਲ੍ਹੇ ਤੋਂ ਬਿਲੋਂਗ ਕਰਦੀ ਹਾਂ ਮੈਂ ਇੱਕ ਪ੍ਰੋਡਕਟ ਮੰਗਾਇਆ ਜੋ ਕਿ ਘੜੀ ਸੀ ਹੱਥ ਦੀ ਗੁੱਟ ਘੜੀ ਰਿਸਟ ਵਾਚ ਇਹ ਗੁਟ ਘੜੀ ਜੋ ਸੀ ਪਹਿਲਾਂ ਤਾਂ ਬਹੁਤ ਵਧੀਆ ਚਲਦੀ ਰਹੀ ਥੋੜ੍ਹੇ ਦਿਨ ਪਰ ਬਾਅਦ ਵਿੱਚ ਅਚਾਨਕ ਆਪਣੇ ਆਪ ਹੀ ਰੁਕ ਗਈ ਅਤੇ ਬੰਦ ਹੋ ਗਈ ਜਦ ਮੈਂ ਮਕੈਨਿਕ ਨੂੰ ਦੱਸਿਆ ਤਾਂ ਪਤਾ ਚੱਲਿਆ ਕਿ ਇਸਦਾ ਸੈਲ ਖਰਾਬ ਹੈ ਫਿਰ ਮੈਂ ਇਸਦੇ ਸੈਲ ਦੀ ਜੋ ਦੇਖਿਆ ਕਿ ਲੀਕ ਹੋ ਚੁੱਕਿਆ ਸੀ ਉਸ ਦੀ ਬਦਲੀ ਕਰਵਾਈ ਸੈਲ ਬਦਲਣ 'ਤੇ ਫਿਰ ਘੜੀ ਚੱਲ ਪਈ ਪਰ ਇਹ ਜ਼ਿਆਦਾ ਦੇਰ ਨਾ ਚੱਲੀ ਚਾਰ ਪੰਜ ਦਿਨਾਂ ਬਾਅਦ ਫਿਰ ਰੁਕ ਗਈ ਮੈਂ ਫਿਰ ਮਕੈਨਿਕ ਕੋਲ ਗਈ ਤਾਂ ਮਕੈਨਿਕ ਕੋਲੋਂ ਪੁੱਛਿਆ ਕਿ ਦਿਖਾਇਆ ਘੜੀ ਨੂੰ ਤਾਂ ਮਕੈਨਿਕ ਕਹਿਣ ਲੱਗਾ ਕਿ ਇਸ ਘੜੀ ਦੀ ਮਸ਼ੀਨ ਦੇ ਵਿੱਚ ਹੀ ਕੋਈ ਖਰਾਬੀ ਹੈ ਸੈਲ ਠੀਕ ਹੈ ਪਰ ਜਦੋਂ ਉਸਨੇ ਮਸ਼ੀਨ ਘੜੀ ਖੋਲ੍ਹੀ ਤਾਂ ਦੇਖਿਆ ਕਿ ਬ੍ਰੈਂਡ ਜੋ ਸੀਗਾ ਉਹ ਕੁਛ ਹੋਰ ਸੀ ਅਤੇ ਜਿਹੜੀ ਵਿੱਚ ਮਸ਼ੀਨ ਸੀ ਕੋਈ ਹੋਰ ਕੰਪਨੀ ਦੀ ਫਿਟ ਕੀਤੀ ਹੋਈ ਸੀ ਹਾਲਾਂਕਿ ਉਹ ਘੜੀ ਮੈਨੂੰ ਮਹਿੰਗੀ ਮਿਲੀ ਸੀ ਤਕਰੀਬਨ ਅੱਠ ਸੌੌੌੌ ਨੌਂ ਸੌ ਦੀ ਸੀ ਪਰ ਘੜੀ ਦੀ ਕੁਆਲਿਟੀ ਦੇ ਹਿਸਾਬ ਦੇ ਨਾਲ ਉਸਨੇ ਆਪਣੀ ਆਉਟਪੁੱਟ ਨਹੀਂ ਦਿੱਤੀ ਜੋ ਕਿ ਇੱਕ ਦੋ ਮਹੀਨੇ ਦੇ ਅੰਦਰ ਹੀ ਖਰਾਬ ਹੋ ਗਈ ਮੈਂ ਬਹੁਤ ਹੀ ਦੁਖੀ ਹੋਈ ਕਿ ਦੇਖੋ ਔਨਲਾਈਨ ਮੰਗਾਈ ਹੋਈ ਚੀਜ਼ ਜੋ ਹੈ ਖਰਾਬ ਨਿਕਲੀ ਪਰ ਇਹ ਜੋ ਨੈਗਟਿਵ ਐਕਸਪੀਰੀਅਸ ਮੇਰਾ ਰਿਹਾ ਇਸ ਦੇ ਨਾਲ ਮੈਨੂੰ ਮੈਂ ਚਾਹੁੰਦੀ ਹਾਂ ਕਿ ਅੱਗੇ ਤੋਂ ਇਹੋ ਜਿਹਾ ਕੰਮ ਕੰਪਨੀ ਵੱਲੋਂ ਨਾ ਕੀਤਾ ਜਾਵੇ ਜਿਸ ਦੇ ਨਾਲ ਦੂਸਰੇ ਕਸਟਮਰ ਦੇ ਨਾਲ ਵੀ ਧੋਖਾਧੜੀ ਨਾ ਕੀਤੀ ਜਾਵੇ ਕਿਰਪਾ ਕਰਕੇ ਅੱਗੇ ਤੋਂ ਇਹ ਚੀਜ਼ ਦੀ ਦੇਖੀ ਜਾਵੇ ਕਿ ਜੋ ਚੀਜ਼ ਮੰਗਵਾਈ ਹੈ ਉਹੀ ਭੇਜੀ ਜਾਵੇ ਧੰਨਵਾਦ